ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਕੀ ਮਹੱਤਤਾ ਹੈ ਮੈਂ ਤੁਹਾਨੂੰ ਭੰਗੜੇ ਬਾਰੇ ਇੱਕ ਵਧੀਆ ਲੰਬਾ ਨਿਬੰਧ ਦੇ ਸਕਦੀ ਹਾਂ ਪੰਜਾਬ ਦੀ ਸਭ ਤੋਂ ਪ੍ਰਸਿੱਧ ਅਤੇ ਉਤਸ਼ਾਹ ਪੂਰਨ ਲੋਕ ਨੱਚ ਸ਼ੈਲੀ ਹੈ ਇਹ ਸਿਰਫ਼ ਇੱਕ ਨੱਚ ਸ਼ੈਲੀ ਨਹੀਂ ਬਲਕਿ ਪੰਜਾਬ ਦੀ ਸੰਸਕ੍ਰਿਤੀ ਇਤਿਹਾਸ ਅਤੇ ਉਤਸ਼ਾਹ ਦਾ ਪ੍ਰਤੀਕ ਹੈ ਭੰਗੜੇ ਦਾ ਸ਼ੁਰੂਆਤ ਮੁੱਢਲੀਆਂ ਵਿੱਚ ਖੇਤੀਬਾੜੀ ਦੇ ਵਿਸਾਖੀ ਦੇ ਦੌਰਾਨ ਹੋਈ ਸੀ ਜਦੋਂ ਕਿਸਾਨ ਆਪਣੀ ਫਸਲ ਦੀ ਕਟਾਈ 'ਤੇ ਖੁਸ਼ੀ ਮਨਾਉਂਦੇ ਹਨ ਭੰਗੜੇ ਦੀ ਜੜ੍ਹਾਂ ਪੰਜਾਬ ਦੇ ਪਿੰਡਾਂ ਵਿੱਚ ਪੁਰਾਣੇ ਸਮਿਆਂ ਵਿੱਚ ਇਹ ਨੱਚ ਮੁੱਖ ਤੌਰ 'ਤੇ ਖੇਤਾਂ ਵਿੱਚ ਮੌਜੂਦ ਕਿਸਾਨਾਂ ਦੁਆਰਾ ਕੀਤਾ ਜਾਂਦਾ ਸੀ ਉਹਨਾਂ ਦੀ ਮਿਹਨਤ ਅਤੇ ਖੁਸ਼ਹਾਲੀ ਦਾ ਪ੍ਰਤੀਕ ਭੰਗੜਾ ਸੀ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਭੰਗੜਾ ਹੈ ਭੰਗੜੇ ਵਿੱਚ ਢੋਲ ਸਭ ਤੋਂ ਮਹੱਤਵਪੂਰਨ ਵਾਧੂ ਹੈ ਜੋ ਨੱਚ ਨੂੰ ਹੋਰ ਵੀ ਜੋਸ਼ੀਲਾ ਬਣਾਉਂਦਾ ਹੈ ਭੰਗੜੇ ਦੇ ਗੀਤ ਪੰਜਾਬੀ ਲੋਕ ਸੰਗੀਤ ਹੈ ਆਧਾਰਤ ਹੁੰਦੇ ਹਨ ਕਿਸਾਨੀ ਮਿਹਨਤ ਅਤੇ ਪ੍ਰੇਮ ਨੂੰ ਦਰਸਾਉਂਦੇ ਹਨ ਇਹ ਨੱਚ ਮੁੱਖ ਤੇ ਅਧਾਰਿਤ ਹੁੰਦਾ ਹੈ ਜਿਵੇਂ ਕਿ ਤਿੱਲੀ ਬੁਖਾਰ ਝੂਮਰ ਫੁਲਕਾਰੀ ਆਦਿ ਅੱਜ ਕੱਲ੍ਹ ਭੰਗੜਾ ਸਿਰਫ਼ ਪੰਜਾਬ ਤੱਕ ਸੀਮਤ ਨਹੀਂ ਬਲਕਿ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੋ ਚੁੱਕਿਆ ਹੈ